ਹਾਂ ਟੈਕਨੋਲਜੀ ਨੇ ਸਾਡੀਆਂ ਬਹੁਤ ਡੋਕਟਰੀ ਲੋੜਾਂ ਪੂਰੀਆਂ ਕੀਤੀਆਂ ਹਨ ਜਿਵੇਂ ਹੁਣ ਮੈਨੂੰ ਕੱਲ੍ਹ ਦੰਦਾਂ ਦੇ ਡਾਕਟਰ ਦੀ ਜ਼ਰੂਰਤ ਸੀ ਤਾਂ ਮੈਂ ਔਨਲਾਈਨ ਸਰਚ ਕੀਤਾ ਕਿ ਡੈਂਟਲ ਡੋਕਟਰ ਕਿਹੜੇ ਹਨ ਮੇਰੇ ਨੀਅਰ ਬਾਏ ਤੱਦ ਗੂਗਲ ਮੈਪ ਨੇ ਬੜੀ ਅੱਛੀ ਫੈਸਿਲਿਟੀ ਆਪਾਂ ਨੂੰ ਦਿੱਤੀ ਹੋਈ ਹੈ ਕਿ ਜਦੋਂ ਵੀ ਮੈਂ ਸਰਚ ਕਰਦੇ ਹੈ ਕਿ ਕਿਹੜਾ ਡੋਕਟਰ ਮੇਰੇ ਨੇੜੇ ਹੈ ਉਹ ਸਾਰੇ ਡੋਕਟਰਾਂ ਦੇ ਨਾਮ ਦੇ ਦਿੰਦਾ ਹੈ ਅਤੇ ਨਾਲ ਸਾਨੂੰ ਉਹਦੀ ਰੇਟਿੰਗ ਵੀ ਦਿੰਦਾ ਹੈ ਤਾਂ ਮੈਨੂੰ ਇਸ ਚੀਜ਼ ਦਾ ਬੜਾ ਵਧੀਆ ਲੱਗਦਾ ਹੈ ਕਿ ਉਹ ਸਾਨੂੰ ਨਾਲ ਦੀ ਨਾਲ ਡਿਸਟੈਂਸ ਦੱਸਦਾ ਹੈ ਕਿ ਸਾਡੇ ਘਰ ਤੋਂ ਜਾਂ ਜਿੱਥੇ ਅਸੀਂ ਰੁਕੇ ਹੋਏ ਹਾਂ ਉੱਥੋਂ ਉਹ ਬੰਦਾ ਉਹ ਡੋਕਟਰ ਕਿੰਨੀ ਦੂਰ ਹੈ ਨਾਲੇ ਸਾਨੂੰ ਉਹਦੀ ਫੀਸ ਦਾ ਦੱਸ ਦਿੰਦਾ ਹੈ ਨਾਲੇ ਜੇ ਫੀਸ ਉਹਨੇ ਅਪਲੋਡ ਕੀਤੀ ਹੈ ਤਾਂ ਨਾਲੇ ਫੀਸ ਦੱਸ ਦਿੰਦਾ ਹੈ ਤੇ ਨਾਲੇ ਸਾਨੂੰ ਉਹਦੀ ਰੇਟਿੰਗ ਦੱਸ ਦਿੰਦਾ ਹੈ ਕਿ ਲੋਕਾਂ ਨੇ ਕਿਵੇਂ ਉਹਨਾਂ ਨੂੰ ਰੇਟ ਕੀਤਾ ਹੈ ਤਾਂ ਅਸੀਂ ਉਸ ਬੇਸਿਸ 'ਤੇ ਆਪਣਾ ਡਸੀਜਨ ਲੈ ਸਕਦੇ ਹਾਂ ਕਿ ਅਸੀਂ ਕਿਹੜੇ ਡੋਕਟਰ ਕੋਲ ਜਾਣਾ ਹੈ ਅਤੇ ਨਾਲੇ ਅਗਰ ਸਲਾਹ ਮਸ਼ਵਰੇ ਦੀ ਗੱਲ ਕਰੀਏ ਤਾਂ ਔਨਲਾਈਨ ਅੱਜ ਕੱਲ੍ਹ ਵੀਡੀਓ ਕੋਂਨਫ੍ਰੈਂਸਿੰਗ ਦੇ ਥਰੂ ਜਾਂ ਕੌਲ ਦੇ ਥਰੂ ਆਪਾਂ ਔਨਲਾਈਨ ਕੌਲ ਵੀ ਕਰ ਸਕਦੇ ਹਾਂ ਡੋਕਟਰ ਨੂੰ ਅਗਰ ਸਾਨੂੰ ਲੱਗਦਾ ਹੈ ਕਿ ਸਾਡੇ ਕੋਈ ਨੀਅਰ ਬਾਏ ਡੋਕਟਰ ਨਹੀਂ ਚੰਗਾ ਹੈ ਕੋਈ ਮੁੰਬਈ ਦਾ ਡੋਕਟਰ ਹੈ ਜਾਂ ਕੋਈ ਵੱਡੇ ਸ਼ਹਿਰ ਦਾ ਡੋਕਟਰ ਹੈ ਜਾਂ ਫੋਰਨ ਦਾ ਡੋਕਟਰ ਹੈ ਜਿਹੜਾ ਸਾਨੂੰ ਬੜਾ ਵਧੀਆ ਲੱਗਦਾ ਹੈ ਜੋ ਸਾਨੂੰ ਅਸੀਂ ਸੁਣਿਆ ਹੈ ਕਿ ਉਹ ਬੜਾ ਚੰਗਾ ਹੈ ਅਤੇ ਸਾਡੀ ਬੜਾ ਐਕਸਪੀਰੀਐਂਸਡ ਹੈ ਅਤੇ ਸਾਡੀ ਬਿਮਾਰੀ ਨੂੰ ਸਮਝੂਗਾ ਤਾਂ ਅਸੀਂ ਔਨਲਾਈਨ ਵੀਡੀਓ ਕੋਂਨਫ੍ਰੈਂਸਿੰਗ ਦੇ ਥਰੂ ਉਨ੍ਹਾਂ ਤੋਂ ਅਪਾਇੰਟਮੈਂਟ ਲੈ ਸਕਦੇ ਹਾਂ ਹਾਂ ਉਹਦੇ ਲਈ ਕੁਛ ਪੇ ਕਰਨਾ ਪੈਂਦਾ ਹੈ ਪਰ ਜੇ ਟੈਕਨੋਲਜੀ ਦੀ ਗੱਲ ਕਰੀਏ ਤਾਂ ਟੈਕਨੋਲਜੀ ਨੇ ਸਾਨੂੰ ਦੂਰ ਦੁਰਾਡੇ ਡੋਕਟਰਾਂ ਨਾਲ ਦੂਰ ਦੁਰਾਡੇ ਦਵਾਈਆਂ ਦੇ ਨਾਲ ਦੂਰ ਦੁਰਾਡੇ ਸਾਇੰਟਿਸਟ ਦੇ ਨਾਲ ਜਿਹੜੇ ਸਾਨੂੰ ਹੈਪਲ ਕਰਦੇ ਹੈ ਸਾਨੂੰ ਉਨ੍ਹਾਂ ਨਾਲ ਜੋੜ ਦਿੱਤਾ ਹੈ ਥੈਂਕਿਊ